ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਸਰ ਮੈਂ ਨਾ ਆਪਣਾ ਔਨਲਾਈਨ ਨੰਬਰ ਕੱਢਿਆ ਸੀ ਤੁਹਾਡਾ ਐਕਚੁਲੀ ਨਾ ਮੈਂ ਕੁਛ ਪੌਦੇ ਲੈਣੇ ਸੀਗੇ ਅਤੇ ਕੁਛ ਫਲਾਵਰ ਲੈਣੇ ਸੀਗੇ ਤਾਂ ਗੈਂਦੇ ਦੇ ਫੁੱਲ ਹੈ ਤੁਹਾਡੇ ਕੋਲ ਗੁਲਾਬ ਗੇਂਦੇ ਦੇ ਗੁਲਾਬ ਦੇ

ਹਾਂਜੀ ਹਾਂਜੀ ਹਾਂਜੀ ਠੀਕ ਹੈ ਅਤੇ ਹੋਰ ਆਪਣੇ ਕੋਲ ਹੋਰ ਮਤਲਬ ਨਿੰਮ ਡੇਕ ਅਤੇ ਤ੍ਰਿਵੇਣੀ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਤੁਹਾਡੇ ਕੋਲ ਜੀ ਅੱਛਾ ਅੱਛਾ ਅੱਛਾ ਨਹੀਂ ਨਹੀਂ ਜੀ ਮੈਂ ਤਾਂ ਨਾ ਔਨਲਾਈਨ ਹੀ ਦੇਖਿਆ ਸੀਗਾ ਅਤੇ ਉੱਥੇ ਫਾਈਵ ਸਟਾਰ ਰੇਟਿੰਗ ਸੀਗੀ ਤੁਹਾਡੇ ਇਹਦੀ ਨਾ ਨਰਸਰੀ ਦੀ ਤਾਂ ਕਰਕੇ ਫਿਰ ਮੈਂ ਕਾਲ ਕੀਤੀ ਮੈਂ ਕਿਹਾ ਚਲੋ ਆਪਣੇ ਘਰ ਦੇ ਨਜ਼ਦੀਕ ਵੀ ਹੈਗਾ ਅਤੇ ਮੈਂ ਕਿਹਾ ਲੈ ਕੇ ਜਾਣੇ ਵੀ ਸੌਖੇ ਆ ਤਾਂ ਫਿਰ ਮੈਂ ਕਿਹਾ ਤੁਹਾਨੂੰ ਫੋਨ ਕਰ ਲੈਂਦੇ ਹਾਂ ਰੇਟ ਕਿੰਨਾ ਕੁ ਲਗਾਉਂਦੇ ਹੋ ਕਿ ਕਿੰਨਾ ਕਿ ਮਾਰਕੀਟ ਦੇ ਰੇਟ ਨਾਲੋਂ ਜ਼ਿਆਦਾ ਤਾਂ ਨਹੀਂ ਰੇਟ ਹੈਗੇ ਅੱਛਾ ਅੱਛਾ ਅੱਛਾ ਹੂੰ ਹੂੰ ਹੂੰ ਅੱਛਾ ਅੱਛਾ ਕੀ ਟਾਈਮਿੰਗ ਰਹਿੰਦੀ ਜੀ ਨਰਸਰੀ ਦੀ ਅੱਗੋਂ ਅੱਛਾ ਸ਼ਾਮ ਸੱਤ ਵਜੇ ਤੱਕ ਹੈ ਅੱਛਾ ਅੱਛਾ ਚਲੋ ਫਿਰ ਮਤਲਬ ਮੈਂ ਇੱਧਰ ਜੋਬ 'ਤੇ ਲੱਗਿਆ ਸੀ ਮੇਰੇ ਨਾ ਪੰਜ ਵਜੇ ਛੁੱਟੀ ਹੁੰਦੀ ਅਤੇ ਛੇ ਵਜੇ ਘਰ ਆਉਂਦਾ ਮੈਂ ਅਤੇ ਮੈਂ ਚਲੋ ਜੇ ਥੋੜ੍ਹਾ ਬਹੁਤ ਲੇਟ ਹੁੰਦਾ ਤੁਹਾਨੂੰ ਫੋਨ ਕਰੂੰਗਾ ਫਿਰ ਮੈਂ ਤੁਹਾਤੇ ਤੁਸੀਂ ਦਸ ਪੰਦਰਾਂ ਮਿੰਟ ਹਾਂਜੀ ਹਾਂਜੀ ਹਾਂਜੀ ਕੁਆਂਟੀ ਦੇਖੋ ਜੀ ਘਰ ਹੀ ਲਗਾਉਣੇ ਆਪਾਂ ਤਾਂ ਨਾ ਘਰ ਮੈਨੂੰ ਪੌਦਿਆਂ ਦਾ ਥੋੜ੍ਹਾ ਜਿਹਾ ਅੱਛਾ ਅੱਛਾ ਅੱਛਾ ਨਹੀਂ ਨਹੀਂ ਨਹੀਂ ਜੀ ਹੂੰ ਘਰ ਹੀ ਘਰ ਹੀ ਲਗਾਉਣੇ ਜੀ ਆਪਾਂ ਤਾਂ ਨਾ ਹਾਂ ਅਤੇ ਥੱਲੇ ਵੀ ਹੈਗਾ ਅਤੇ ਉੱਪਰ ਛੱਤ 'ਤੇ ਵੀ ਲਗਾਉਣੇ ਆ ਜੀ ਮਤਲਬ ਦੋਨੋਂ ਹੀ ਹੈ ਵੀ ਨੀਚੇ ਵੀ ਹੈਗੀ ਆ ਜਗ੍ਹਾ ਆਪਣੇ ਕੋਲ ਉੱਤੇ ਵੀ ਲੱਗਦੇ ਥੋੜ੍ਹੇ ਬਹੁਤ ਪੌਦੇ ਲੱਗੇ ਵੀ ਹੋਏ ਆ ਹੁਣ ਗਰਮੀ ਜ਼ਿਆਦਾ ਨਾ ਤਾਂ ਸੜ ਗਏ ਆ ਮਤਲਬ ਨਾ ਪਾਣੀ ਤਾਂ ਪਾਈ ਜਾਂਦੇ ਹਾਂ ਪਰ ਗਰਮੀ ਜ਼ਿਆਦਾ ਹੋਣ ਕਰਕੇ ਕੀ ਆ ਬੂਟੇ ਖਰਾਬ ਹੋ ਰਹੇ ਆ ਅਤੇ ਖਾਦ ਵੀ

ਹੂੰ ਹੂੰ ਹੂੰ ਠੀਕ ਹੈ ਠੀਕ ਹੈ ਜੀ ਹੂੰ ਹੂੰ ਹੂੰ ਅੱਛਾ ਅੱਛਾ ਠੀਕ ਹੈ ਠੀਕ ਹੈ ਚਲੋ ਫਿਰ ਤਾਂ ਵਧੀਆ ਹੈ ਨਾ ਜੀ ਹਾਂਜੀ ਹਾਂਜੀ ਮੇਰਾ ਪਲੈਨ ਤਾਂ ਹੈਗਾ ਜੀ ਬਾਕੀ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸ ਦੂੰਗਾ ਵੀ ਅੱਜ ਆਇਆ ਜਾਂਦਾ ਨਹੀਂ ਤਾਂ ਕਿ ਕੱਲ੍ਹ ਆਇਆ ਜਾਂਦਾ ਕੱਲ੍ਹ ਮੇਰੀ ਛੁੱਟੀ ਹੋਈ ਹੈ ਅਤੇ ਹੋਪਫੁਲੀ ਸ਼ਾਇਦ ਮੈਂ ਅੱਜ ਅੱਜ ਹੀ ਟਰਾਈ ਕਰੂੰਗਾ ਵੀ ਅੱਜ ਹੀ ਆ ਜਾ ਹੂੰ ਹੂੰ ਹੂੰ ਠੀਕ ਠੀਕ ਹੈ ਜੀ ਥੈਂਕ ਯੂ ਓਕੇ ਜੀ ਥੈਂਕ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਠੀਕ ਓਕੇ ਥੈਂਕ ਯੂ ਜੀ